ਇਸ ਵੱਲ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲੋਕਡਾਊਨ ਤੋਂ ਬਾਅਦ ਮੋਬਾਇਲ ਲੈਪਟੋਪ ਦੀ ਬਹੁਤ ਜ਼ਿਆਦਾ ਵਰਤੋਂ ਸ਼ੁਰੂ ਕਰ ਦਿੱਤੀ ਕਿਉਂਕਿ ਲੋਕਟਾਈਮ ਲੋਕਡਾਊਨ ਦੇ ਟਾਈਮ ਆਪਾਂ ਸਾਰੇ ਘਰ ਵਿੱਚ ਵਿਹਲੇ ਸੀਗੇ ਆਪਾਂ ਘਰ ਤੋਂ ਬਾਹਰ ਜਾਣਾ ਨਹੀਂ ਸੀ ਸਭ ਕੋਲ ਵਾਧੂ ਟਾਈਮ ਸੀ ਸਭ ਕੋਲੋਂ ਫ਼ੋਨ ਮੋਬਾਇਲ ਲੈਪਟੋਪ ਸੀਗੇ ਸਾਰੇ ਘਰ ਬੈਠੇ ਫ਼ੋਨਾਂ 'ਤੇ ਲੈਪਟੋਪ ਨ 'ਤੇ ਹੀ ਸਾਰਾ ਕੁਛ ਕਰਦੇ ਸੀ ਮੋਬਾਇਲ ਦੀ ਜ਼ਿਆਦਾ ਵਰਤੋਂ ਹੋ ਗਈ ਕਿਉਂਕਿ ਬਾਹਰ ਨਾ ਤਾਂ ਅਖ਼ਬਾਰ ਆਉਂਦੇ ਸੀ ਲੋਕਡਾਊਨ ਦੇ ਟਾਈਮ ਨਾ ਆਪਾਂ ਕਿਸੇ ਨੂੰ ਮਿਲ ਸਕਦੇ ਸੀ ਆਪਣੀ ਸਾਰੀ ਜਿੰਨਾ ਵੀ ਟਾਈਮ ਪਾਸ ਦਾ ਸਾਧਨ ਸੀ ਉਹ ਮੋਬਾਇਲ ਜਾਂ ਲੈਪਟੋਪ ਹੋ ਗਏ ਲੈਪਟੋਪ 'ਤੇ ਹੀ ਮੋਬਾਈਲਾਂ 'ਤੇ ਆਪਾਂ ਨੂੰ ਸਾਰੇ ਦੇਸ਼ਾਂ ਦੀਆਂ ਗੱਲਾਂ ਖ਼ਬਰਾਂ ਪਤਾ ਲੱਗਦੀਆਂ ਸੀ ਇਸ ਕਰਕੇ ਇਹ ਕਹਿ ਲਉ ਕਿ ਆਪਾਂ ਨੂੰ ਮੋਬਾਇਲ ਦੀ ਆਦਤ ਵੀ ਪੈ ਗਈ ਸੀ ਲੋਕਡਾਊਨ ਅਤੇ ਲੋਕਡਾਊਨ ਦੇ ਦੌਰਾਨ ਫਿਰ ਪਹਿਲਾਂ ਤਾਂ ਚਲੋ ਸਕੂਲ ਕੋਲੇਜ ਨਹੀਂ ਲੱਗਦੇ ਸੀ ਪਰ ਫਿਰ ਸ ਔਨਲਾਈਨ ਸਕੂਲਿੰਗ ਸ਼ੁਰੂ ਹੋ ਗਈ ਘਰ ਆਫ਼ਿਸ ਵਾਲੇ ਸਾਰਿਆਂ ਦੇ ਘਰਾਂ ਤੋਂ ਕੰਮ ਹੋ ਗਿਆ ਕਿਉਂਕਿ ਕਿੰਨੀ ਕੁ ਦੇਰ ਘਰ ਬੈਠ ਸਕਦੇ ਸੀ ਸਕੂਲ ਵੀ ਸ਼ੁਰੂ ਹੋ ਗਏ ਪਰ ਮੇਰੇ ਅਕੋਡਿੰਗ ਜਦੋਂ ਔਨਲਾਈਨ ਸਕੂਲਿੰਗ ਸ਼ੁਰੂ ਹੋਈ ਇਹ ਤਾਂ ਸੀ ਕਿ ਚਲੋ ਪੜ੍ਹਾਈ ਦਾ ਨੁਕਸਾਨ ਬਚ ਗਿਆ ਬੱਚੇ ਸਕੂਲ ਬੈਠੇ ਪੜ੍ਹ ਰਹੇ ਸੀ ਘਰ ਪਰ ਨਿਆਣਿਆਂ ਦਾ ਧਿਆਨ ਘੱਟ ਹੁੰਦਾ ਸੀ ਨਿਆਣੇ ਕੌ ਫ਼ੋਨ ਔਨ ਕਰਕੇ ਲੈਪਟੋਪ ਔਨ ਕਰਕੇ ਕਲਾਸ ਔਨ ਕਰਕੇ ਧਿਆਨ ਓਨਾ ਨਹੀਂ ਲਗਾ ਸਕਦੇ ਸੀ ਜਿੰਨਾ ਕਿ ਆਪਾਂ ਕਲਾਸ 'ਚ ਟੀਚਰ ਤੋਂ ਸਿੱਖ ਸਕਦੇ ਨਿਆ ਬੱਚਿਆਂ ਨੂੰ ਕੀ ਹੋ ਗਿਆ ਕਿ ਬੱਚਿਆਂ ਦਾ ਲਿਖਣ ਦਾ ਰੁਝਾਨ ਘੱਟ ਗਿਆ ਪੜ੍ਹਨ ਦਾ ਰੁਝਾਨ ਘੱਟ ਗਿਆ ਲਿਖਦੇ ਤਾਂ ਹੈ ਹੀ ਨਹੀਂ ਸੀ ਫ਼ੋਨ 'ਤੇ ਬਸ ਸੁਣਦੇ ਸੀ ਨਾ ਹੀ ਰੀਡਿੰਗ ਦਾ ਵੀ ਧਿਆਨ ਘ ਘੱਟ ਗਿਆ ਉਹ ਰੀਡ ਨਹੀਂ ਕਰ ਪਾਉਂਦੇ ਸੀ ਉੱਤੋਂ ਅੱਧੇ ਨਿਆਣੇ ਤਾਂ ਆਪਣਾ ਕੈਮਰਾ ਬੰਦ ਕਰਕੇ ਟੱਪਦੇ ਫਿਰਦੇ ਰਹਿੰਦੇ ਸਨ ਟਿੱਕ ਕੇ ਤਾਂ ਬੈਠਦੇ ਨਹੀਂ ਸੀ ਅਤੇ ਕਿੰਨਾ ਕੁ ਉਹਦੇ 'ਚ ਬਹੁਤਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੋਇਆ ਐਵੇਂ ਘਰ ਤੋਂ ਕੰਮ ਕਰਨ ਲਈ ਹੁਣ ਘਰ 'ਚ ਕੰਮ ਕਰਨਾ ਆ ਆਦਮੀਆਂ ਲਈ ਤਾਂ ਸੰਭਵ ਸੀ ਪਰ ਔਰਤਾਂ ਜਦ ਕੰਮ ਕਰਨ ਬੈਠਦੀਆਂ ਸਨ ਕੋਈ ਨਾ ਕੋਈ ਪਿੱਛੋਂ ਆਵਾਜ਼ ਮਾਰ ਲੈਂਦਾ ਸੀ ਸਾਡਾ ਧਿਆਨ ਉਸ ਹਿਸਾਬ ਨਾਲ਼ ਨਹੀਂ ਲੱਗਦਾ ਸੀ ਵਿੱਚ ਹੀ ਬੱਚੇ ਰੌਲਾ ਪਾਉਂਦੇ ਸੀ ਤਾਂ ਉਹ ਕੰਮ ਜਿੰਨਾ ਕੰਮ ਆਪਾਂ ਦਫ਼ਤਰ ਵਿੱਚ ਬੈਠ ਕੇ ਇੱਕ ਮਨ ਹੋ ਕੇ ਕਰ ਸਕਦੇ ਹਾਂ ਉਹ ਆਪਾਂ ਔਨਲਾਈਨ ਨਹੀਂ ਕਰ ਸਕਦੇ